ਬਿਲਕੁਲ ਇਹ ਸਿਖਾਉਣ ਦੀ ਬੜੀ ਜ਼ਰੂਰਤ ਹੈ ਸਰ ਇਸ ਵਿੱਚ ਬੈਂਕ ਦੇ ਵਰਕਫਲੋ ਨੀਤੀਆਂ ਦੇ ਰਿਟਰਨ ਟੈਕਸ ਬਾਰੇ ਸਿੱਖਣ ਨਾਲ ਬੱਚਿਆਂ ਨੂੰ ਆਰਥਿਕ ਵਿਅਸਤ ਜੀਵਨ ਵਿੱਚ ਸਹਾਇਤਾ ਮਿਲਦੀ ਹੈ ਮਾਪਦੰਡ ਨਿਰਧਾਰਤ ਹੋ ਸਕਦੇ ਹਨ ਉਹਨਾਂ ਨੂੰ ਆਰਥਿਕ ਸਮਝ ਅਤੇ ਫਾਈਨੈਂਸ਼ੀਅਲ ਲਿਸਟ ਵਿੱਚ ਵੱਧ ਅਗਵਾਈ ਅਤੇ ਸੁਧਾਰ ਕਰਨ ਵਿੱਚ ਇਸ ਤਰ੍ਹਾਂ ਉਹ ਆਪਣੇ ਆਰਥਿਕ ਵਿੱਤੀਆਂ ਦੇ ਸਹਾਇਕ ਸੀ ਪ੍ਰਤੀ ਪ੍ਰਬੰਧ ਨਿਯੰਤਰਣ ਵਿੱਚ ਹੁਸ਼ਿਆਰ ਹੋ ਸਕਣਗੇ